ਖਾਣਾ ਬਣਾਉਣ ਤੋਂ ਪਹਿਲਾਂ ਵਾਰੀ ਆਉਂਦੀ ਹੈ ਸਬਜ਼ੀਆਂ ਦੇ ਕੱਟਣ ਅਤੇ ਮਸਾਲੇ ਬਣਾਉਣ ਦੀ ਸਭ ਤੋਂ ਪਹਿਲਾਂ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਕੱਟ ਲਈਦੀਆਂ ਨੇ ਅਤੇ ਫਿਰ ਮਸਾਲਾ ਬਣਾਉਣ ਲਈ ਲਸਣ ਛਿਲ ਕੇ ਗੰਢੇ ਚੀਰ ਕੇ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਵਿੱਚ ਟਮਾਟਰ ਪਾ ਕੇ ਗਰਾਈਂਡਰ ਨਾਲ ਮਸਾਲਾ ਤਿਆਰ ਕਰ ਲਈ ਦਾ ਹੈ ਪਹਿਲਾਂ ਤਾਂ ਇਹ ਮਸਾਲਾ ਵੀ ਦੌਰੀ ਡੰਡੇ ਨਾਲ ਕੁੱਟਣਾ ਪੈਂਦਾ ਸੀ ਮੈਨੂੰ ਲੱਗਦਾ ਦਸ ਪੰਦਰਾਂ ਮਿੰਟ ਤਾਂ ਉੱਥੇ ਨਿਕਲ ਜਾਂਦੇ ਹੋਣਗੇ ਪਰ ਅੱਜ ਕੱਲ੍ਹ ਗਰਾਈਂਡਰ ਨਾਲ ਇਹ ਕੰਮ ਛੇਤੀ ਹੀ ਹੋ ਜਾਂਦਾ ਦਾਲ ਬਣਾਉਣੀ ਹੋਵੇ ਤਾਂ ਪਹਿਲਾਂ ਹੀ ਰਾਤ ਨੂੰ ਦਾਲਾਂ ਭਿਓ ਲਈ ਦੀਆਂ ਨੇ ਤਾਂ ਜੋ ਛੇਤੀ ਗਲ ਜਾਣ ਚਾਵਲਾਂ ਨੂੰ ਨੂੰ ਵੀ ਅੱਧਾ ਕੁ ਘੰਟਾ ਪਹਿਲਾਂ ਹੀ ਭਿਓ ਲਈ ਦਾ ਇਹ ਤਾਂ ਹੋਈ ਤਿਆਰੀ ਦਾਲਾਂ ਦੀ ਪਰ ਇਸ ਤੋਂ ਇਲਾਵਾ ਜੇ ਕਦੇ ਸਾਗ ਪਾਲਕ ਜਾਂ ਮੇਥੀ ਬਣਾਉਣੀ ਹੋਵੇ ਤਾਂ ਹਾਏ ਰੱਬਾ ਉਦੋਂ ਤਾਂ ਮਾਨੋ ਤਿੰਨ ਚਾਰ ਘੰਟੇ ਪਾਰ ਕੱਲਾ ਕੱਲਾ ਪੱਤਾ ਕਰਕੇ ਸਾਫ ਕਰੋ ਚੰਗੀ ਤਰ੍ਹਾਂ ਧੋਵੋ ਫਿਰ ਕੱਟੋ ਅਤੇ ਤੜ ਫਿਰ ਤੜਕੇ ਤੋਂ ਪਹਿਲਾਂ ਚੰਗੀ ਤਰ੍ਹਾਂ ਰਿੰਨੋ ਰੋਟੀ ਬਣਾਉਣ ਤੋਂ ਪਹਿਲਾਂ ਵੀ ਆਟਾ ਗੁੰਨ ਕੇ ਰੱਖਣਾ ਪੈਂਦਾ ਅਤੇ ਜੇ ਗੱਲ ਕਰੀਏ ਮਸਾਲਿਆਂ ਦੀ ਅਤੇ ਮਸਾਲੇ ਜਿਹੜੇ ਅਸੀਂ ਨਮਕ ਮਿਰਚ ਮਸਾਲੇ ਵਿੱਚ ਪਾਉਣੇ ਨੇ ਉਹ ਵੀ ਜੀਰਾ ਭੁੰਨ ਕੇ ਰੱਖਣਾ ਪੈਂਦਾ ਭੁੰਨ ਕੇ ਸਾਬਤ ਹਰਾ ਧਨ ਹਰਾ ਧਨੀਆ ਤਾਂ ਪਾਈਦਾ ਹੀ ਪਾਈਦਾ ਪਰ ਸਾਬਤ ਸੁੱਕਾ ਧਨੀਆ ਵੀ ਪਹਿਲਾਂ ਹੀ ਮਸਲ ਕੇ ਕੁੱਟ ਕੇ ਰੱਖਣਾ ਪੈਂਦਾ ਇਹ ਸਾਰੀਆਂ ਤਿਆਰੀਆਂ ਪਹਿਲਾਂ ਹੀ ਬੀਬੀਆਂ ਕਰਕੇ ਰੱਖ ਲੈਂਦੀਆਂ ਨੇ ਤਾਂ ਜੋ ਕ ਕੰਮ ਕਰਨ 'ਚ ਦੇਰੀ ਨਾ ਹੋਵੇ